ਜੇ ਵਿਕਾਸ ਦੀ ਗੱਲ ਕਰੀਏ ਤਾਂ ਮੋਹਾਲੀ ਜ਼ਿਲ੍ਹਾ ਬਹੁਤ ਵਿਕਾਸ ਕਰ ਚੁੱਕਾ ਹੈ ਜਿੱਥੇ ਰਹਿਣ ਸਹਿਣ ਦੀ ਗੱਲ ਹੈ ਇੱਥੇ ਬਹੁਤ ਸਾਰੇ ਫਲੈਟ ਅਪਾਰਟਮੈਂਟ ਕਿਰਾਏ 'ਤੇ ਮਿਲ ਜਾਂਦੇ ਹਨ ਜਿਵੇਂ ਛੋਟੇ ਪਰਿਵਾਰ ਨੇ ਰਹਿਣਾ ਹੈ ਉਸ ਦਾ ਕਿਰਾਇਆ ਸੱਤ ਤੋਂ ਅੱਠ ਹਜ਼ਾਰ ਹੈ ਵੱਡੇ ਪਰਿਵਾਰ ਦਾ ਕਿਰਾਇਆ ਦਸ ਬਾਰ੍ਹਾਂ ਹਜ਼ਾਰ ਦੇ ਵਿੱਚ ਹੈ ਜੇ ਫਲੈਟ ਲੈਣਾ ਹੈ ਤਾਂ ਫਲੈਟ ਚਾਲੀ ਪੰਤਾਲੀ ਲੱਖ ਦਾ ਹੈ